ਪੰਜਾਬ ਵਿੱਚ ਸਿਹਤ ਕਰਮਚਾਰੀ ਵੱਡ ਵਧੀਆ ਇੰਸ ਇੰਸੀਚਿਊਟ ਕੋਲਜਾਂ ਤੋਂ ਆਪਣੀ ਸਿਹਤ ਦੀ ਸਿੱਖ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਸਿਹਤ ਸੰਭਾਲ ਦੇ ਵਿੱਚ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਜਿਵੇਂ ਕੀ ਕੋਵਿਡ ਦੌਰਾਨ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਹੀ ਆਪਣੀ ਵਧੀਆ ਸੇਵਾਵਾਂ ਨਿਭਾਈਆਂ ਹਨ ਔਰ ਗੱਲ ਕਰਦੇ ਹਾਂ ਪੇਸ਼ੇਵਰ ਜਿਹੜੇ ਡੋਕਟਰ ਨਾਮਵਰ ਡਾਕਟਰ ਉਹਨਾਂ ਦੇ ਸਾਹਮਣੇ ਜੋ ਚੁਣੌਤੀਆਂ ਆ ਰਹੀਆਂ ਹਨ ਉਹਨਾਂ ਅਤੇ ਇਕਿਊਮੈਂਟ ਦੀ ਘਾਟ ਕਰਕੇ ਉਹ ਪਬਲਿਕ ਲਈ ਵਧੀਆ ਇਲਾਜ ਮੁਹੱਈਆ ਨਹੀਂ ਕਰਾ ਸਕਦੇ ਇਹਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਗੌਰਮੈਂਟ ਹੋਸਪਿਟਲ ਨੇ ਇਹਨਾਂ ਦੇ ਵਿੱਚ ਹਰ ਵਧੀਆ ਇਕਿਊਮੈਂਟ ਪਹੁੰਚਾਉਣਾ ਚਾਹੀਦਾ ਹੈ ਜਾਂ ਤਾਂ ਜੋ ਗਰੀਬ ਲੋਕ ਇਲਾਜ ਲਈ ਵੱਡੇ ਅਤੇ ਮਹਿੰਗੇ ਹੋਸਪਿਟਲਾਂ ਦੇ ਵਿੱਚ ਨਾ ਜਾਣ